ਰੇਲ ਗੱਡੀ ਇੱਕ ਬਹੁਤ ਵਧੀਆ ਸਾਧਨ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਮੈਂ ਅਕਸਰ ਹੀ ਸ਼ੋਪਿੰਗ ਵਾਸਤੇ ਰੋਪੜ ਤੋਂ ਲੁਧਿਆਣੇ ਵੱਲ ਜਾਂਦਾ ਹਾਂ ਰੇਲ ਗੱਡੀ ਦੇ ਰਾਹੀਂ